ਪੰਜਾਬ ਵਿੱਚ ਟੈਕਨੋਲਜੀ ਸੈਕਟਰ ਦਾ ਦੂਜੇ ਸੈਕਟਰਾਂ ਨਾਲ ਕਾਫੀ ਸਹਿਯੋਗ ਹੈ ਜਿਵੇਂ ਹੁਣ ਆਪਾਂ ਕਈ ਤਰ੍ਹਾਂ ਦੇ ਟੈਕਨੋਲਜੀ ਯੂਜ ਕਰਦੇ ਹਾਂ ਜਿੱਦਾਂ ਮਾਈਕਰੋਸੋਫਟ ਆਫਿਸ ਇੰਸਟੈਂਟ ਮੈਸੇਜਿੰਗ ਅਤੇ ਪ੍ਰੋਜੈਕਟ ਮੈਨੇਜਮੈਂਟ ਇੱਦਾਂ ਦੀਆਂ ਚੀਜ਼ਾਂ ਨਾ ਆਪਾਂ ਆਪਣਾ ਪ੍ਰੋਜੈਕਟ ਵਧੀਆ ਕਰ ਸਕਦੇ ਹਾਂ ਜਿੱਦਾਂ ਹੁਣ ਦਫ਼ਤਰਾਂ 'ਚ ਕਈ ਤਰ੍ਹਾਂ ਦੇ ਟੈਕਨੋਲੋਜੀ ਆ ਗਈ ਹੈ ਜਿਸ ਵਿੱਚ ਮਾਈਕਰੋਸੋਫਟ ਐਕਸੈਲ ਐਮ ਐਸ ਵਰਡ ਆਦਿ ਚੀਜ਼ਾਂ ਨਾਲ ਆਪਾਂ ਆਪਣਾ ਡਾਟਾ ਤਿਆਰ ਕਰਦੇ ਹਾਂ ਐਮ ਐਸ ਐਕਸਲ ਦੇ ਨਾਲ ਆਪਾਂ ਆਪਣੇ ਸ਼ੀਟਸ ਵਗੈਰਾ ਬਣਾ ਸਕਦੇ ਹਾਂ ਉਸ ਨਾਲ ਆਪਾਂ ਜੋੜ ਖਾਤਾ ਵੀ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ ਇਸ ਵਿੱਚ ਕਈ ਤਰ੍ਹਾਂ ਦੇ ਹੋਰ ਵੀ ਫੰਕਸ਼ਨ ਦਿੱਤੇ ਜਾਂਦੇ ਹੈ ਜਿਹੜੇ ਸਾਡੇ ਕੰਮ ਕਾਫੀ ਸੌਖਾ ਕਰ ਦਿੰਦੇ ਆ ਇਸ ਤੋ ਇਲਾਵਾ ਹੁਣ ਟੈਕਨੋਲੋਜੀ ਦਾ ਇਸਤੇਮਾਲ ਸਿਕਿਉਰਟੀ ਦੇ ਵੀ ਕੀਤਾ ਜਾਂਦਾ ਹੈ ਜਿਵੇਂ ਹੁਣ ਆਪਾਂ ਘਰ ਬੈਠੇ ਹੀ ਆਪਣਾ ਕੈਮਰੇ ਦਾ ਕੰਟਰੋਲ ਕਰ ਸਕਦੇ ਹਾਂ ਆਪਾਂ ਕੈਮਰੇ ਨਾਲ ਦੇਖ ਸਕਦੇ ਹਾਂ ਕੌਣ ਕੀ ਕਰ ਰਿਹਾ ਸਾਡੇ ਘਰ ਅਤੇ ਇਸ ਤੋਂ ਇਲਾਵਾ ਹੁਣ ਆਪਾਂ ਲਾਈਟ ਪੱਖੇ ਆਦੀ ਚੀਜ਼ਾਂ ਵੀ ਹੁਣ ਟੈਕਨੋਲੋਜੀ ਨਾਲ ਕੰਟਰੋਲ ਕਰ ਸਕਦੇ ਹਾਂ ਹੁਣ ਜੇ ਆਪਾਂ ਦਫ਼ਤਰਾਂ 'ਚ ਦੇਖੀਏ ਦਫ਼ਤਰਾਂ 'ਚ ਅੱਜ ਕੱਲ੍ਹ ਅਟੈਂਡੈਂਸ ਸਿਸਟਮ ਵੀ ਆਉਣ ਲੱਗ ਪਿਆ ਹੈ ਜਿਸ ਨਾਲ ਬੰਦਾ ਆਪਣਾ ਅੰਗੂਠਾ ਰੱਖ ਕੇ ਆਪਣੀ ਅਟੈਂਡਸ ਲਾ ਦਿੰਦਾ ਹੈ ਅਤੇ ਦਫ਼ਤਰਾਂ 'ਚ ਪਤਾ ਲੱਗ ਜਾਂਦਾ ਕਿ ਉਹ ਬੰਦਾ ਅੱਜ ਆਇਆ ਹੈ ਅਤੇ ਇਸ ਤੋਂ ਇਲਾਵਾ ਔਨਲਾਈਨ ਸਿਸਟਮ ਵੀ ਕਾਫੀ ਚੜੇ ਨੇ ਜਿਸ ਵਿੱਚ ਆਪਾਂ ਆਪਣਾ ਸਮ ਸਮਾਨ ਅਤੇ ਡਾਟਾ ਦੂਜੇ ਬੰਦੇ ਨੂੰ ਭੇਜ ਸਕਦੇ ਹਾਂ ਅਤੇ ਇਹ ਡਾਟਾ ਕੁਝ ਹੀ ਪਲਾਂ ਵਿੱਚ ਉਹਨਾਂ ਕੋਲ ਪਹੁੰਚ ਜਾਂਦਾ ਹੈ ਜਿਹੜਾ ਸਾਡਾ ਕੰਮ ਕਾਫੀ ਸੌਖਾ ਅਤੇ ਵਧੀਆ ਕਰ ਦਿੰਦਾ